ਸਤਿ ਸ਼੍ਰੀ ਅਕਾਲ ਜੀ ਤੁਸੀਂ ਮੀਸ਼ੋ ਤੋਂ ਬੋਲਦੇ ਪਏ ਹੋ ਹਾਂਜੀ ਮੈਂ ਰੰਜਨਾ ਕੁਲਰ ਬੋਲਦੀ ਪਈ ਹਾਂ ਪਿੱਛੇ ਇੱਕ ਹਫਤਾ ਹੋਇਆ ਅਜੇ ਮੈਂ ਇੱਕ ਜੈਕਿਟ ਮੰਗਵਾਈ ਸੀ ਬਲੈਕ ਕਲਰ ਦੀ ਜੈਕਿਟ ਸੀ ਉੱਥੇ ਦੇਖਣ 'ਚ ਇੱਦਾਂ ਲੱਗ ਰਿਹਾ ਸੀ ਕਿ ਡਾਰਕ ਬਲੈਕ ਹੈ ਲਿਖਿਆ ਵੀ ਹੋਇਆ ਸੀ ਡਾਰਕ ਬਲੈਕ ਜਦੋਂ ਮੈਂ ਮੰਗਵਾਈ ਉਹ ਫਿੱਕਾ ਜਿਹਾ ਕਲਰ ਆਇਆ ਅਤੇ ਮੈਂ ਸਾਈਜ਼ ਵੀ ਨਾ ਮੀਡੀਅਮ ਮੰਗਵਾਇਆ ਸੀ ਆਇਆ ਵੀ ਸਮਾਲ ਬਟਨ ਉੜ ਲੱਥੇ ਹੋਏ ਹੈ ਮੈਂ ਹੁਣ ਮੈਨੂੰ ਹੁਣ ਦਿੱਕਤ ਹੀ ਬਹੁਤ ਹੈ ਜੇ ਮੈਂ ਸਿਲਵਾ ਵੀ ਲਵਾਂ ਤਾਂ ਵੀ ਵਧੀਆ ਨਹੀਂ ਲੱਗੇਗੀ ਜੇ ਮੈਂ ਸਿਲਵਾਉਣੀ ਹੁੰਦੀ ਤਾਂ ਮੈਂ ਮੰਗਵਾਉਣੀ ਕਿਉਂ ਸੀ ਹਾਂਜੀ ਮੈਨੂੰ ਚੇਂਜ ਕੀਤੀ ਹੋਈ ਚਾਹੀਦੀ ਹੈ ਜੇ ਇਹ ਚੇਂਜ ਨਹੀਂ ਕਰ ਸਕਦੇ ਤਾਂ ਮੈਨੂੰ ਪੈਸੇ ਵਾਪਸ ਕਰ ਦਿਉ ਹਾਂਜੀ ਤੁਸੀਂ ਕਰ ਦਿਉਗੇ ਚੇਂਜ ਹਾਂਜੀ ਉਹ ਮੈਂ ਇਹੀ ਨੰਬਰ 'ਤੇ ਮੰਗਵਾਇਆ ਸੀ ਆਈ ਡੀ ਵੀ ਮੇਰੀ ਰੰਜਨਾ ਕੁਲਰ ਨਾਮ 'ਤੇ ਮੇਰੀ ਆਈ ਡੀ ਹੋਏਗੀ ਹਾਂਜੀ ਤੁਸੀਂ ਮੈਂ ਫਿਰ ਤੁਹਾਨੂੰ ਫੋਨ ਕਰੂੰਗੀ ਅਤੇ ਤੁਸੀਂ ਚੱਕ ਲਿਓ ਪਲੀਜ਼ ਹਾਂਜੀ ਉਹ ਪਹਿਲੇ ਇੱਕ ਤਾਂ ਇਹ ਗੱਲ ਹੋਈ ਇੱਕ ਤਾਂ ਹੋਰ ਦਿੱਕਤ ਸੀ ਕਿ ਉੱਥੇ ਲਿਖਿਆ ਹੋਇਆ ਸੀ ਕਿ ਦੋ ਦਿਨ ਬਾਅਦ ਆ ਜਾਊਗਾ ਪਰ ਆਇਆ ਵੀ ਇੱਕ ਹਫਤੇ ਬਾਅਦ ਜਦੋਂ ਮੇਰਾ ਫੰਕਸ਼ਨ ਵੀ ਨਿਕਲ ਗਿਆ ਹੁਣ ਮੈਨੂੰ ਇਹ ਫਾਇਦਾ ਹੀ ਕੀ ਹੋਇਆ ਮੈਨੂੰ ਹਾਂਜੀ ਧੰਨਵਾਦ ਜੀ